ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਗਨਪ੍ਰੀਤ ਕੌਰ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਪੰਜਾਬ ਵਿੱਚ ਬਹੁਤ ਸਾਰੇ ਲੇਖਕ ਹਨ ਅਤੇ ਲੇਖਕ ਅਤੇ ਕਵੀ ਹਨ ਪਰ ਕੁਝ ਲੇਖਕ ਸਾਰੇ ਲੇਖਕਾਂ ਵਿੱਚੋਂ ਮੈਨੂੰ ਨੰਦ ਲਾਲ ਨੂਰਪੁਰੀ ਦੀ ਕਵਿਤਾ ਚੰਗੀ ਲੱਗਦੀ ਹੈ ਕਿਉਂਕਿ ਉਹ ਮੇਰੀ ਰੂਹ ਤੱਕ ਰੂਹ ਨੂੰ ਛੂਹ ਲੈਂਦੀ ਹੈ ਅਤੇ ਉਹ ਮੇਰੇ ਮਨ ਮਨ ਨੂੰ ਛੂਹ ਲੈਂਦੀ ਹੈ ਨੰਦ ਲਾਲ ਨੂਰਪੁਰੀ ਦੀ ਕਵਿਤਾ ਵਿੱਚ ਚਾਰ ਸਾਹਿਬਜ਼ਾਦਿਆਂ ਬਾਰੇ ਦੱਸਿਆ ਗਿਆ ਹੈ ਅਤੇ ਇਸ ਵਿੱਚ ਇਸ ਕਵਿਤਾ ਦਾ ਨਾਮ ਚੁੰਮ ਚੁੰਮ ਰੱਖਾਂ ਕਲਗੀ ਜੁਝਾਰ ਬਾਰੇ ਦੱਸਿਆ ਗਿਆ ਹੈ ਅਤੇ ਇਸ ਵਿੱਚ ਮਾਤਾ ਗੁਜਰੀ ਜੀ ਬਾਰੇ ਅਤੇ ਚਾਰ ਸਾਹਿਬਜ਼ਾਦਿਆਂ ਬਾਰੇ ਦੱਸਿਆ ਗਿਆ ਹੈ ਅਤੇ ਇਹ ਖਾਲਸਾ ਪੰਥ ਦੇ ਬਾਰੇ ਦੱਸਿਆ ਗਿਆ ਅਤੇ ਇਹ ਇਤਿਹਾਸਿਕ ਕਵਿਤਾ ਹੈ ਅਤੇ ਇਹ ਮਨ ਤੱਕ ਪਹੁੰਚਦੀ ਹੈ ਅਤੇ ਇਸ ਵਿੱਚ ਮਤਲਬ ਕਿ ਚਾਰ ਸਾਹਿਬਜ਼ਾਦੇ ਉਹਨਾਂ ਦੇ ਨਾਲ ਕੀ ਕੀ ਹੋਇਆ ਅਤੇ ਉਹਦੇ ਬਾਰੇ ਦੱਸਿਆ ਗਿਆ ਅਤੇ ਮਾਤਾ ਗੁਜਰੀ ਜੀ ਬਾਰੇ ਦੱਸਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਜੋ ਕਿ ਚਾਰ ਸਾਹਿਬਜ਼ਾਦਿਆਂ ਦੇ ਪਿਤਾ ਸੀ ਉਹਨਾਂ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਉਹਨਾਂ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਚਾਰ ਸਾਹਿਬਜ਼ਾਦੇ ਦੋ ਜੰਗ ਵਿੱਚ ਸ਼ਹੀਦ ਹੋ ਗਏ ਅਤੇ ਦੋ ਸਾਹਿਬਜ਼ਾਦੇ ਨੀਹਾਂ ਵਿੱਚ ਚਿਣਾ ਦਿੱਤੇ ਗਏ ਅਤੇ ਮਾਤਾ ਗੁਜਰੀ ਕਿੱਦਾਂ ਆਪਣੇ ਬੱਚਿਆਂ ਦੇ ਨਾਲ ਚਾਰ ਸਾਹਿਬਜ਼ਾਦਿਆਂ ਦੇ ਨਾਲ ਠੰਡੇ ਬੁਰਜ਼ ਵਿੱਚ ਰਹੇ ਉਹਦੇ ਬਾਰੇ ਦੱਸਿਆ ਗਿਆ ਹੈ ਅਤੇ ਠੰਡੇ ਠੰਡੇ ਬੁਰਜ਼ ਵਿੱਚ ਰਹਿ ਕੇ ਉਹਨਾਂ ਨੇ ਕਿਵੇਂ ਉੱਥੇ ਬੱਚਿਆਂ ਨੇ ਉੱਥੇ ਆਪਣੀ ਨਾ ਹੀ ਕਿਸੇ ਦੇ ਧਰਮ ਨੂੰ ਅਪਣਾਇਆ ਇਹਦੇ ਬਾਰੇ ਵੀ ਦੱਸਿਆ ਗਿਆ ਉਹਨਾਂ ਨੇ ਉੱਥੇ ਆਪਣੇ ਆਪਣੇ ਧਰਮ ਦੇ ਵਿੱਚ ਅਟੂਟ ਰਹੇ ਅਤੇ ਉਹਨਾਂ ਨੇ ਆਪਣੇ ਪਿਤਾ ਦੀ ਸਿੱਖਿਆ ਉੱਤੇ ਚੱਲੇ ਇਹਦੇ ਉ ਇਹਦੇ ਬਾਰੇ ਵੀ ਦੱਸਿਆ